ਕਿਸਾਨ ਖੇਤੀ ਦੇ ਨਾਲ਼ ਨਾਲ਼ ਦੁੱਧ ਦਾ ਕੰਮ ਕਰ ਸਕਦੇ ਹਨ ਅਤੇ ਉਹ ਫ਼ਲ਼ ਸਬਜ਼ੀਆਂ ਦਾ ਕੰਮ ਕਰ ਸਕਦੇ ਹਨ ਅਤੇ ਉਹ ਆਪਣੇ ਟਰੈਕਟਰ ਟਰਾਲੀ ਨੂੰ ਕਾਰੋਬਾਰ ਦੇ ਤੌਰ 'ਤੇ ਵਰਤ ਸਕਦੇ ਹਨ ਆਪਣੇ ਟਰੈਕਟਰ ਟਰਾਲੀ ਨੂੰ ਲੈ ਕੇ ਉਹ ਕਿਰਾਇਆ ਕਰ ਸਕਦੇ ਹਨ ਜਿਸ ਨਾਲ਼ ਉਨ੍ਹਾਂ ਨੂੰ ਚੰਗੀ ਕਮਾਈ ਮਿਲ ਸਕਦੀ ਹੈ ਅਤੇ ਉਹਨਾਂ ਨੂੰ ਫ਼ਲ਼ ਸਬਜ਼ੀਆਂ ਫਰੂਟ ਵੇਚ ਕੇ ਵੀ ਸੋਹਣੀ ਕਮਾਈ ਮਿਲ ਸਕਦੀ ਹੈ